ਖੇਡਾਂ ਸਾਡੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਉਂਦੀਆਂ ਹਨ ਖੇਡਾਂ ਮਾਨਸਿਕ ਤੰਦਰੁਸਤੀ ਵਿੱਚ ਸਾਨੂੰ ਜਿੱਥੇ ਸੋਚਣ ਸਮਝਣ ਦੀ ਸ਼ਕਤੀ ਦਿੰਦੀਆਂ ਹਨ ਉੱਥੇ ਹੀ ਸਾਨੂੰ ਮਿਲ ਜੁਲ ਕੇ ਰਹਿਣ ਦੀ ਭਾਵਨਾ ਵੀ ਪ੍ਰਗਟ ਕਰਦੀਆਂ ਹਨ ਖੇਡਾਂ ਇੱਕ ਮਨੁੱਖ ਲਈ ਖੇਡਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਹਨ ਕਿਉਂਕਿ ਇਹ ਸਾਨੂੰ ਇੱਕ ਦੇਸ਼ ਨਾਲ ਨਹੀਂ ਇੱਕ ਸੂਬੇ ਨਾਲ ਨਹੀਂ ਬਲਕਿ ਦੋ ਇਨਸਾਨਾਂ ਨੂੰ ਆਪਸ ਵਿੱਚ ਜੋੜਦੀਆਂ ਹਨ ਇਸ ਨਾਲ ਸਰੀਰ ਦੀ ਤੰਦਰੁਸਤੀ ਵੀ ਬਣੀ ਰਹਿੰਦੀ ਹੈ ਅਤੇ ਕਈ ਨੌਜਵਾਨ ਜੋ ਅੱਜ ਕੱਲ੍ਹ ਨਸ਼ਿਆਂ ਦੇ ਰਾਹ ਉੱਤੇ ਤੁਰ ਪਏ ਹਨ ਖੇਡਾਂ ਖੇਡਣ ਨਾਲ ਉਹ ਇਸ ਤੋਂ ਬਚੇ ਰਹਿ ਸਕਦੇ ਹਨ ਇਸ ਨਾਲ ਸਾਨੂੰ ਕੋਈ ਪ੍ਰਕਾਰ ਦੀਆਂ ਬਿਮਾਰੀਆਂ ਨਹੀਂ ਲੱਗਦੀਆਂ ਅਤੇ ਆਪਸ ਵਿੱਚ ਮਿਲ ਜੁਲ ਕੇ ਰਹਿਣ ਦੀ ਭਾਵਨਾ ਪੈਦਾ ਹੁੰਦੀ ਹੈ ਜਿੱਤਣਾ ਜਾਂ ਹਾਰਨਾ ਇੱਕ ਪਾਸੇ ਦੀ ਗੱਲ ਹੁੰਦੀ ਹੈ ਪਰ ਫਿਰ ਖੇਡਾਂ ਵਿੱਚ ਭਾਗ ਲੈਣਾ ਭਾਗ ਲੈਣਾ ਇੱਕ ਵੱਡੀ ਉਪਲਬਧੀ ਹੁੰਦੀ ਹੈ ਜਿਸ ਕਾਰਨ ਆਪਸ ਵਿੱਚ ਮਿਲ ਜੁਲ ਕੇ ਔਰ ਏਕਤਾ ਦੀ ਭਾਵਨਾ ਪੈਦਾ ਹੁੰਦੀ ਰਹਿੰਦੀ ਹੈ ਜਿਵੇਂ ਕਿ ਹ ਅੱਜ ਕੱਲ੍ਹ ਸਾਡੇ ਪੰਜਾਬ ਵਿੱਚ ਪ੍ਰ ਮੁੱਖ ਮੰਤਰੀ ਦੁਆਰਾ ਖੇਡਾਂ ਅਯੋ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਇਸਦਾ ਮਕਸਦ ਸਿਰਫ ਇਹ ਹੀ ਹੈ ਕਿ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਇੱਕ ਚੰਗੀ ਜੀਵਨਸ਼ੈਲੀ ਬਖਸ਼ੀ ਜਾਵੇ